ਹਾਂਜੀ ਸਾਨੂੰ ਪਾਣੀ ਦੀ ਸਪਲਾਈ ਮਿਲਦੀ ਆ ਪਾਣੀ ਦੀ ਸਪਲਾਈ ਹੈ ਜਿਹੜੀ ਟੂਟੀ ਦੇ ਪਾਣੀ 'ਤੇ ਵੀ ਆਉਂਦੀ ਹੈ ਕਿਉਂਕਿ ਟੂਟੀ ਦਾ ਪਾਣੀ ਹੈ ਜਿਹੜਾ ਕਿ ਨਹਿਰਾਂ ਝੀਲਾਂ ਅਤੇ ਵੱਖ ਵੱਖ ਪਾਣੀ ਦੇ ਸਰੋਤਾਂ ਤੋਂ ਆਉਂਦਾ ਹੈ ਕਿਉਂਕਿ ਇਹਦੇ ਇਹ ਹੀ ਪਾਣੀ ਸਾਡੀਆਂ ਟੂਟੀਆਂ ਦੇ ਵਿੱਚ ਆਉਂਦਾ ਹੈ ਇਹ ਹੀ ਪਾਣੀ ਪੀਣ ਯੋਗ ਹੁੰਦਾ ਹੈ ਇੱਥੋਂ ਤੱਕ ਕਿ ਅ ਜਦੋਂ ਇਹ ਪਾਣੀ ਨਹਿਰਾਂ ਜਾਂ ਝੀਲਾਂ ਤੋਂ ਆਉਂਦਾ ਹੈ ਤਾਂ ਅਗਾਂਹ ਸਾਡੇ ਕ ਤੱਕ ਘਰਾਂ ਤੱਕ ਇਹ ਪਾਣੀ ਫਿਲਟਰ ਹੋ ਕੇ ਪਹੁੰਚਦਾ ਹੈ ਕਿਉਂਕਿ ਫਿਲਟਰ ਹੋਇਆ ਪਾਣੀ ਹੀ ਅਸੀਂ ਪੀ ਸਕਦੇ ਹਾਂ ਜੇਕਰ ਪਾਣੀ ਫਿਲਟਰ ਹੋਇਆ ਨਾ ਹੋਵੇ ਤਾਂ ਸਾਡੀ ਸਿਹਤ ਨੂੰ ਨੁਕਸਾਨਦਾਇਕ ਹੁੰਦਾ ਹੈ ਬਿਨਾਂ ਫਿਲਟਰ ਕੀਤਾ ਪਾਣੀ ਸਾਡੀ ਸਿਹਤ ਨੂੰ ਨੁਕਸਾਨਦਾਇਕ ਕਰ ਸਕਦਾ ਬਹੁਤ ਸਾਰੀਆਂ ਬਿਮਾਰੀਆਂ ਲੱਗ ਸਕਦੀਆਂ ਨੇ ਕਿਉਂਕਿ ਪਾਣੀ ਇਕੱਲੇ ਮਨੁੱਖ ਹੀ ਨਹੀਂ ਪੀਂਦੇ ਸਗੋਂ ਪਸ਼ੂ ਪੰਛੀ ਜਾ ਜਾਨਵਰ ਆਦਿ ਇਹ ਵੀ ਸਾਰੇ ਪਾਣੀ ਪੀਂਦੇ ਨੇ ਪਾਣੀ ਅੱਜ ਦੇ ਟਾਈਮ ਦੇ ਵਿੱਚ ਸਾਰਿਆਂ ਲਈ ਬਹੁਤ ਜ਼ਰੂਰੀ ਹੈ ਕਿਉਂਕਿ ਪਾਣੀ ਹੈ ਜਿਹੜਾ ਕਿ ਸਾਡੀ ਪਿਆਸ ਬੁਝਾਉਂਦਾ ਅਸੀਂ ਕਿਤੇ ਵੀ ਹੋਈਏ ਤਾਂ ਸਾਨੂੰ ਪਾਣੀ ਬਹੁਤ ਜ਼ਰੂਰੀ ਹੁੰਦਾ ਹਜੇ ਅਸੀਂ ਰੋਟੀ ਤੋਂ ਬਿਨਾਂ ਰਹਿ ਸਕਦੇ ਹਾਂ ਪਰ ਅਸੀਂ ਪਾਣੀ ਤੋਂ ਬਿਨਾਂ ਇੱਕ ਮਿੰਟ ਵੀ ਨਹੀਂ ਰਹਿ ਸਕਦੇ ਅਤੇ ਸਾਡੇ ਘਰ ਵਿੱਚ ਪਾਣੀ ਟੂਟੀ ਦੀ ਸਪਲਾਈ ਆਉਂਦੀ ਹੈ ਅਤੇ ਇਹ ਪਾਣੀ ਸਾਫ਼ ਹੁੰਦਾ ਹੈ ਅਤੇ ਜਿਹੜਾ ਕਿ ਅਸੀਂ ਪੀਣ ਲਈ ਵੀ ਵਰਤਦੇ ਹਾਂ ਘਰ ਦੇ ਬਹੁਤ ਸਾਰੇ ਕੰਮਾਂ ਲਈ ਵੀ ਪਾਣੀ ਵਰਤਿਆ ਜਾਂਦਾ ਜਿਵੇਂ ਕਿ ਕੱਪੜੇ ਧੋਣੇ ਭਾਂਡੇ ਧੋਣੇ ਹੋਰ ਘਰ ਦੇ ਬਹੁਤ ਸਾਰੇ ਕੰਮਾਂ ਲਈ ਵੀ ਇਹ ਪਾਣੀ ਦੀ ਲੋੜ ਹੁੰਦੀ ਹੈ ਅਤੇ ਪਾਣੀ ਵਰਤਿਆ ਜਾਂਦਾ ਹੈ ਕਿਉਂਕਿ ਪਾਣੀ ਜਿੰਨਾ ਹੀ ਸਾਫ਼ ਹੋਵੇਗਾ ਸਾਡੇ ਲਈ ਪੀਣ ਯੋਗ ਹੋਵੇਗਾ ਸਾਨੂੰ ਅਸੀਂ ਬਿਮਾਰੀਆਂ ਤੋਂ ਬਚੇ ਰਹਿ ਸਕਦੇ ਹਾਂ ਅਗਰ ਪਾਣੀ ਹੀ ਸਾਫ਼ ਨਾ ਹੋਵੇਗਾ ਤਾਂ ਪੀਣ ਯੋਗ ਕੇ ਕਿੱਥੋਂ ਰਹਿ ਸਕਦਾ ਹੈ ਕਿਉਂਕਿ ਪਾਣੀ ਦੇ ਵਿੱਚ ਮਿਲਣ ਵਾਲੇ ਰਹਿੰਦ ਖੁੰਹਦ ਗੰਦ ਪਦਾਰਥ ਜਿਹੜੇ ਕਿ ਸਾਡੀ ਸਿਹਤ ਨੂੰ ਹਾਨੀਕਾਰਕ ਹੋ ਸਕਦੇ ਨੇ ਸਾਡੀ ਸਿਹਤ 'ਤੇ ਅਸਰ ਪਾ ਸਕਦੇ ਨੇ ਬੁਰਾ ਅਸਰ ਪਾਉਂਦੇ ਨੇ ਉਹ ਉਹਨਾਂ ਨਾਲ ਬਿਮਾਰੀਆਂ ਫੈਲਦੀਆਂ ਨੇ ਜਿਹਨਾਂ ਨਾਲ ਕਿ ਬਹੁਤ ਸਾਰੀਆਂ ਬਿਮਾਰੀਆਂ ਬਣ ਜਾਂਦੀਆਂ ਨੇ ਜਿੱਦਾਂ ਕਿ ਸਾਨੂੰ ਲੇਬਰ ਦੀ ਪ੍ਰੋਬਲਮ ਅਤੇ ਹੋਰ ਅੰਦਰੂਨੀ ਬਹੁਤ ਸਾਰੀਆਂ ਬਿਮਾਰੀਆਂ ਜੋ ਕਿ ਗੰਦੇ ਪਾਣੀ ਨਾਲ ਸਾਡੀ ਸਿਹਤ 'ਤੇ ਬਹੁਤ ਬੁਰੇ ਤਰੀਕੇ ਨਾਲ ਅਸਰ ਕਰਦੀਆਂ ਨੇ ਅਤੇ ਇਹ ਪ੍ਰਭਾਵ ਹੈ ਜੋ ਕਿ ਸਾਨੂੰ ਬਹੁਤ ਹੀ ਜ਼ਿਆਦਾ ਸਾਡੀ ਸਿਹਤ ਨੂੰ ਖ਼ਰਾਬ ਕਰ ਸਕਦਾ ਹੈ ਪਾਣੀ ਫਿਲਟਰ ਕੀਤਾ ਹੀ ਸਾਡੀਆਂ ਟੂਟੀਆਂ ਦੇ ਵਿੱਚ ਆਉਂਦਾ ਹੈ ਅਤੇ ਉਹ ਪਾਣੀ ਹੀ ਅਸੀਂ ਅਗਾਂਹ ਹੋਰ ਫਿਲਟਰ ਕਰਕੇ ਆ ਆਪਣੇ ਕੋਲ ਸਟੋਰ ਕਰਕੇ ਅਤੇ ਫਿਲਟਰ ਤਰੀਕੇ ਨਾਲ ਫਿਲਟਰ ਕਰਕੇ ਪੀ ਸਕਦੇ ਹਾਂ